ਅਸੀਂ ਮਤਲਬ ਕਿ ਬਹੁਤ ਹੀ ਆਪਣਾ ਖਿਆਲ ਰੱਖਦੇ ਹਾਂ ਆਪਣੇ ਘਰਾਂ ਵਿੱਚ ਆਮ ਕਰਕੇ ਆਪਣੇ ਪੇਂਡੂ ਇਲਾਕਾ ਹੈ ਜੀ ਇਹ ਚੀਜ਼ਾਂ ਆਮ ਹਨ ਕਿ ਕੋਕਰੋਚ ਚੂਹੇ ਚੂਹੇ ਖਾਸ ਕਰਕੇ ਮੱਖੀ ਮੱਛਰ ਬਹੁਤ ਹੀ ਤੰਗ ਕਰਦੇ ਹਨ ਪਰੇਸ਼ਾਨੀ ਕਰਦੇ ਹਨ ਅਸੀਂ ਤਾਂ ਆਪਣਾ ਮਤਲਬ ਕਿ ਰਸੋਈ ਵਿੱਚ ਖਾਸ ਇਹੀ ਧਿਆਨ ਰੱਖਦੇ ਹਨ ਕਿ ਆਪਣਾ ਜਦੋਂ ਵੀ ਰਸੋਈ ਵਿੱਚ ਪਹਿਲਾਂ ਤਾਂ ਰਸੋਈ ਦੀ ਐਨ ਸਾਫ ਸਫਾਈ ਰਸੋਈ ਦੇ ਕੋਨੇ ਖਿੜਕੀਆਂ ਉੱਪਰ ਰੋਸ਼ਨਦਾਨ ਸਾਰਿਆਂ ਦੀ ਸਫਾਈ ਥੱਲੇ ਅਤੇ ਅਸੀਂ ਧਿਆਨ ਰੱਖਦੇ ਹਨ ਕਿ ਆਪਣਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਇਹੋ ਜਿਹਾ ਕੋਈ ਕੀੜਾ ਮਕੌੜਾ ਨਾ ਹੋਵੇ ਜੋ ਕਿ ਆਪਣੇ ਖਾਣੇ ਪੀਣੇ ਪਰ ਆਪਣੀ ਰਹਿੰਦ ਖੁੰਹਦ ਛੱਡ ਕੇ ਕਿ ਬਿਮਾਰੀ ਦਾ ਘਰ ਬਣਾਵੇ ਆਪਣੇ ਘਰ ਨੂੰ ਅਸੀਂ ਇਹ ਗੱਲ ਦਾ ਬਹੁਤ ਹੀ ਬਹੁਤ ਹੀ ਜ਼ਿਆਦਾ ਖਿਆਲ ਰੱਖਦੇ ਹਨ ਕਿ ਸਾਡੇ ਘਰ ਵਿੱਚ ਜਿਵੇਂ ਬੱਚੇ ਹਨ ਉਹ ਉਹਨਾਂ ਨੂੰ ਆਦਤ ਹੁੰਦੀ ਆ ਆਪਣੇ ਛੋਟੇ ਬੱਚਿਆਂ ਨੂੰ ਕਿ ਉਹ ਚੋਕਲੇਟ ਕੁਰਕੁਰੇ ਜੋ ਵੀ ਖਾ ਪੀ ਕੇ ਘਰ ਦੇ ਆਲੇ ਦੁਆਲੇ ਖੂੰਜਿਆਂ ਵਿੱਚ ਸੁੱਟ ਦਿੰਦੇ ਹਨ ਇਹੀ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ ਕੀੜੇ ਮਕੌੜੇ ਇੱਥੋਂ ਇਹ ਘਰ ਵਿੱਚ ਐਂਟਰ ਕਰਦੇ ਹਨ ਇੱਥੇ ਇਹਨਾਂ ਨੇ ਮੁਸ਼ਕ ਸੁੰਘ ਕੇ ਇਹ ਅੰਦਰ ਆਉਂਦੇ ਹਨ ਅਤੇ ਚੂਹੇ ਜ਼ਿਆਦਾ ਕਰਕੇ ਜ਼ਿਆਦਾ ਪਰੇਸ਼ਾਨੀ ਇਸ ਲਈ ਕਰਦੇ ਹਨ ਕਿਉਂਕਿ ਉਹ ਦੂੜਾ ਬਣਾ ਕੇ ਆਪਣੇ ਕੱਚੇ ਮਕਾਨ ਸਨ ਪਹਿਲਾਂ ਉਹਨਾਂ ਵਿੱਚ ਦੂੜਾ ਆਸਾਨੀ ਨਾਲ ਬਣ ਜਾਂਦੀਆਂ ਸੀ ਅੰਦਰ ਆ ਕੇ ਉਹ ਦੂੜਾ ਰਾਹੀਂ ਆਪਣਾ ਜੋ ਵੀ ਘਰ ਦਾ ਮਤਲਬ ਕਿ ਸਾਰਾ ਹੀ ਨੁਕਸਾਨ ਕਰ ਜਾਂਦੇ ਸੀ ਉਹੀ ਦੂੜਾ ਰਾਹੀਂ ਸੱਪ ਦੂੜਾ ਮਤਲਬ ਕਿ ਖੁੱਡ ਮਤਲਬ ਕਿ ਸੁਰਾਖ ਰਾਹੀਂ ਅੰਦਰ ਆਪਣਾ ਆਉਂਦੇ ਸੀ ਐਂਟਰ ਕਰਦੇ ਸੀ ਅਤੇ ਉਹਨਾਂ ਦੇ ਮਗਰ ਮਗਰ ਸੱਪ ਵੀ ਉਹੀ ਖੁੱਡਾਂ ਰਾਹੀਂ ਆਉਂਦੇ ਸੀ ਇਸ ਲਈ ਇਹ ਸਾਨੂੰ ਜਾਨਲੇਵਾ ਵੀ ਬਹੁਤ ਵਾਰੀ ਮਤਲਬ ਕਿ ਖਤਰਾ ਸਾਡਾ ਬਚਾਅ ਹੋਇਆ ਕਿ ਅਸੀਂ ਮਤਲਬ ਕਿ ਆਪਣਾ ਦੇਖ ਲਿਆ ਚੈੱਕ ਕਰ ਲਿਆ ਤਾਂ ਅਸੀਂ ਇਹੀ ਕਹਾਂਗੇ ਕਿ ਆਪਣਾ ਜਦੋਂ ਵੀ ਜਾਣਾ ਤਾਂ ਆਪਣਾ ਸਫਾਈ ਦਾ ਖਿਆਲ ਰੱਖੋ